ਪੰਜਾਬ ਦਾ ਵਿਰਸਾ ਬਹੁਤ ਅਮੀਰ ਵਿਰਸਾ ਹੈ ਇਸਨੇ ਬਹੁਤ ਕਲਾਵਾਂ ਨੂੰ ਜਨਮ ਦਿੱਤਾ ਹੈ ਪੰਜਾਬ ਦੀ ਕਲਾ ਅਤੇ ਸ਼ਿਲਪ ਕਲਾ ਵਿੱਚ ਲੱਕੜੀ ਦਾ ਕੰਮ ਬਹੁਤ ਪ੍ਰਸਿੱਧ ਹੈ ਲੱਕੜੀ ਦੇ ਕਾਰੀਗਰਾਂ ਦੁਆਰਾ ਵੱਖ ਵੱਖ ਤਰ੍ਹਾਂ ਦੇ ਨਕਾਸ਼ੀ ਡਿਜ਼ਾਇਨਰ ਫਰਨੀਚਰ ਬਣਾਉਣ ਦੀ ਪਰੰਪਰਾ ਰਹੀ ਹੈ ਪੰਜਾਬ ਵਿੱਚ ਬਣੀਆਂ ਲੱਕੜੀ ਦੀਆਂ ਕਲਾਂ ਕ੍ਰਿਤੀਆਂ ਦੁਨੀਆਂ ਭਰ ਵਿੱਚ ਮਸ਼ਹੂਰ ਹਨ ਪੰਜਾਬ ਵਿੱਚ ਆਉਣ ਵਾਲੇ ਬਾਹਰਲੇ ਯਾਤਰੀ ਇੱਥੋਂ ਦੇ ਸ਼ਿਲਪਕਾਰਾਂ ਦੁਆਰਾ ਘੜੀਆਂ ਚੀਜ਼ਾਂ ਇਕੱਠੀਆਂ ਕਰਕੇ ਲੈ ਜਾਂਦੇ ਹਨ ਇਸ ਵਿੱਚ ਫੁਲਕਾਰੀ ਬਾਗ ਜੋ ਇੱਕ ਪ੍ਰਕਾਰ ਦੀ ਕਢਾਈ ਹੁੰਦੀ ਹੈ ਅਤੇ ਸੂਟਾਂ ਅਤੇ ਚੁੰਨੀਆਂ ਚਾਦਰਾਂ 'ਤੇ ਕੱਢੀ ਜਾਂਦੀ ਹੈ ਇਹ ਕਢਾਈ ਨੂੰ ਕੱਢਣ ਲਈ ਕਾਫ਼ੀ ਕੁਸ਼ਲਤਾ ਅਤੇ ਸਮੇਂ ਦੀ ਲੋੜ ਹੁੰਦੀ ਹੈ ਇਹ ਪੰਜਾਬ ਦੀ ਪਾਰੰਪਰਿਕ ਕਲਾ ਹੈ ਜੋ ਪੰਜਾਬੀ ਲੋਕ ਕਲਾ ਨੂੰ ਦੀ ਚੰਗੀ ਉਦਾਹਰਨ ਹੈ ਇਸ ਤੋਂ ਇਲਾਵਾ ਮੰਜੇ ਪੀੜ੍ਹੀਆਂ ਦਰੀਆਂ ਆਦਿ ਵੱਖ ਵੱਖ ਰੰਗਾਂ ਦੇ ਸੂਤਾਂ ਨਾਲ ਬੁਣੀਆ ਜਾਂਦੀਆਂ ਹਨ ਚਮੜੇ ਦੀਆਂ ਜੁੱਤੀਆਂ ਬਣਾਉਣਾ ਵੀ ਇਸ ਕਲਾ ਦਾ ਇੱਕ ਹਿੱਸਾ ਹੈ ਮਿੱਟੀ ਦੇ ਭਾਂਡੇ ਲੋਹੇ ਦੇ ਭਾਂਡੇ ਉਹਨਾਂ 'ਤੇ ਪੇਂਟਿੰਗ ਕਰਨ ਦਾ ਕੰਮ ਵੀ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਟੋਕਰੀ ਸਾਜੀ ਆਦਿ ਦਾ ਕੰਮ ਵੀ ਕੀਤਾ ਜਾਂਦਾ ਹੈ ਇਹਨਾਂ ਹੱਥ ਸ਼ਿਲਪਾ ਨਾਲ ਕਈ ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਨਾਲ ਜੁੜੀਆਂ ਹੁੰਦੀਆਂ ਹਨ ਜਿਹੜੀਆਂ ਕਿ ਕਲਚਰਲ ਟੂਰਿਜ਼ਮ ਨੂੰ ਬਹੁਤ ਹੀ ਬੜਾਵਾ ਦਿੰਦੀਆਂ ਹਨ